ਗੁਲਾਬ ਜਾਮੁਨ ਜਲੇਬੀ ਬੂਰ ਬੂਰੀ ਪਿੰਨੀ ਲੱਡੂ ਪੇਠਾ ਮਾਲਪੂੜੇ ਫਿਰਨੀ ਕਾਜੂ ਬਰਫ਼ੀ ਸੇਵੀਆਂ ਦੀ ਖੀਰ ਮੱਖਣ ਪੇਸਟੀ ਚੋਕਲੇਟ ਕੇਕ ਵਨੀਲਾ ਪੇਸਟੀ ਫਰੂਟ ਪੇਸਟੀ ਪਾਈਨਐਪਲ ਪੇਸਟਰੀ

ਸਿੱਧੀ ਹਲਵਾ ਬਾਲੂ ਸ਼ਾਹੀ ਚਨਾ ਬਰਫ਼ੀ ਖੋਆ ਬਰਫ਼ੀ ਬੇਸਨ ਦੀ ਬਰਫ਼ੀ ਰਸਗੁੱਲਾ ਰਸ ਮਲਾਈ ਢੋਡਾ ਬਰਫ਼ੀ ਸੱਤੂ ਦੀ ਪਿੰਨੀ ਗਾਜਰ ਦਾ ਹਲਵਾ ਮੋਤੀ ਚੂਰ ਦੇ ਲੱਡੂ ਸੂਜੀ ਦਾ ਹਲਵਾ ਮਖਾਨੇ ਦੀ ਖੀਰ ਪੈਨੀ ਚੂਰਮਾ ਸਟੋਬਰੀ ਪੇਸਟੀ ਬਲੈਕ ਫੋਰਮਿਟ ਕੇਕ ਰੈਡ ਵੈਲਵਟ ਪੇਸਟੀ ਚੀਜ਼ ਕੇਕ ਓਲਮੰਡ ਕੇਕ ਕੈਰਮਲ ਪੇਸਟੀ ਅੰਡੇ ਰਹਿਤ ਕੇਕ ਹਨੀ ਕੇਕ ਚੋਕਲੇਟ ਮਫੀਨ ਧੰਨਵਾਦ